ਔਫਲਾਈਨ ਭਰਾਵਾਂ ਦਾ ਢਾਬਾ ਰੈਸਟੋਰੈਂਟ ਮੈਨੇਜਰ ਸਰ ਸਾਡਾ ਟੇਬਲ ਲੱਗ ਚੁੱਕਾ ਹੈ ਹਾਲ ਵਿੱਚ ਟੇਬਲ ਨੰਬਰ ਪੰਜ ਸਾਡਾ ਔਡਰ ਲਿਖੋ ਮੋਮੋਜ ਇਡਲੀ ਡੋਸਾ ਮਲਾਈ ਚਾਂਪਾਂ ਸਪਰਿੰਗ ਰੋਲ ਨਿਊਡਲ ਅਤੇ ਮੈਗੀ ਸਰ ਇਹਨਾਂ ਚੀਜ਼ਾਂ ਵਿੱਚੋਂ ਤੁਸੀਂ ਮਸਾਲਾ ਮਿਰਚ ਬਹੁਤ ਘੱਟ ਪਾਇਓ ਤਾਂ ਕਿ ਸਾਡੇ ਬੱਚੇ ਨਾਲ਼ ਹੈ ਉਹਨਾਂ ਨੂੰ ਖਾਣ ਵਿੱਚ ਕੋਈ ਦਿੱਕਤ ਨਾ ਆਵੇ ਅਸਾਨੀ ਨਾਲ਼ ਖਾ ਸਕਣ ਇਸ ਤੋਂ ਇਲਾਵਾ ਸਰ ਤੁਹਾਡੇ ਪ੍ਰਸਿੱਧ ਪਕਵਾਨ ਅਸੀਂ ਅਜ਼ਮਾਉਣਾ ਚਾਹੁੰਦੇ ਹਾਂ ਸਾਨੂੰ ਟੇਸਟ ਕਰਵਾਉ ਤਾਂ ਕਿ ਅਸੀਂ ਅੱਗੇ ਜਾ ਕੇ ਕਿਸੇ ਹੋਰ ਨੂੰ ਵੀ ਇਸ ਹੋਟਲ ਬਾਰੇ ਰੈਸਟੋਰੈਂਟ ਬਾਰੇ ਤੁਹਾਨੂੰ ਦੱਸ ਸਕੀਏ ਸਾਨੂੰ ਮਿੱਠੇ ਵਿੱਚ ਸਰ ਮਿੱਠੇ ਵਿੱਚ ਰਸ ਮਲਾਈ ਦੇ ਦਿਉ ਅਸੀਂ ਉਹ ਵੀ ਔਰਡਰ ਕਰਨਾ ਚਾਹੁੰਦੇ ਹਾਂ ਮਿੱਠੇ ਵਿੱਚ ਮਿੱਠਾ ਬਹੁਤ ਸਰ ਘੱਟ ਹੋਵੇ ਇਸ ਤੋਂ ਇਲਾਵਾ ਸਰ ਸਾਨੂੰ ਬਿੱਲ ਦੇ ਦਿਉ ਤਾਂ ਕਿ ਅਸੀਂ ਆਪਣਾ ਬਿੱਲ ਵੀ ਪੇਅ ਕਰ ਸਕੀਏ ਥੈਂਕ ਯੂ